ਸਤਿ ਸ਼੍ਰੀ ਅਕਾਲ ਜੀ ਮੈਂ ਬਹੁਤ ਸਾਰੇ ਵੱਖ ਵੱਖ ਪਕਾਉਣ ਪਕਵਾਨ ਬਣਾਉਣੇ ਸਿੱਖੇ ਹਨ ਜਿਨ੍ਹਾਂ ਵਿੱਚੋਂ ਕੁਝ ਪਕਵਾਨ ਮੈਂ ਆਪਣੇ ਮਾਤਾ ਜੀ ਤੋਂ ਬਣਾਉਣੇ ਸਿੱਖੇ ਹਨ ਅਤੇ ਕੁਝ ਮੈਂ ਆਪਣੇ ਔਨਲਾਈਨ ਸਿੱਖੇ ਹਨ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਇਹਨਾਂ ਨੂੰ ਕੁਕਿੰਗ ਦੇ ਵਿੱਚ ਬਹੁਤ ਦਿਲਚਸਪੀ ਰਹੀ ਹੈ ਮੈਂ ਆਪਣੇ ਮਾਤਾ ਜੀ ਤੋਂ ਜੋ ਅਸੀਂ ਆਪ ਘਰ ਵਿੱਚ ਖਾਣਾ ਬਣਾਉਂਦੇ ਹਾਂ ਉਹ ਬਣਾਉਣਾ ਸਿੱਖਿਆ ਅਤੇ ਔਨਲਾਈਨ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਹਨ ਜਿਸ ਤਰ੍ਹਾਂ ਕਿ ਪੀਜ਼ਾ ਬਣਾਉਣਾ ਬਰਗਰ ਬਣਾਉਣਾ ਅਤੇ ਪਾਸਤਾ ਬਣਾਉਣਾ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਸਾਨੂੰ ਦੂਸਰੇ ਦੇਸ਼ਾਂ ਦੇ ਜੋ ਪ੍ਰਸਿੱਧ ਪਕਵਾਨ ਹਨ ਉਹ ਬਣਾਉਣੇ ਸਿੱਖੇ ਜਿਵੇਂ ਕਿ ਡੋਕਲਾ ਬਣਾਉਣਾ ਅੱਪੇ ਬਣਵਾਉਣਾ ਅਤੇ ਹੋਰ ਵੀ ਬਹੁਤ ਸਾਰੀਆਂ ਜੋ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਚੀਜ਼ਾਂ ਪ੍ਰਸਿੱਧ ਹਨ ਉਹ ਬਣਾਉਣੀਆਂ ਸਿੱਖੀਆਂ ਅਤੇ ਮੈਨੂੰ ਸਭ ਤੋਂ ਸੌਖਾ ਖੀਰ ਬਣਾਉਣਾ ਲੱਗਦਾ ਹੈ ਕਿਉਂਕਿ ਉਸ ਵਿੱਚ ਬਹੁਤ ਹੀ ਘੱਟ ਵਿਅੰਜਨ ਪੈਂਦੇ ਹਨ ਅਤੇ ਉਸਦਾ ਸਮਾਂ ਵੀ ਬਹੁਤ ਘੱਟ ਲੱਗਦਾ ਹੈ ਅਤੇ ਉਹ ਬਣਾਉਣੀ ਵੀ ਬਹੁਤ ਸੌਖੀ ਹੈ ਅਤੇ ਉਹ ਆਪਾਂ ਛੇਤੀ ਵੀ ਬਣਾ ਸਕਦੇ ਹਾਂ ਅਤੇ ਉਹ ਖਾਣ ਦੇ ਨਾਲ ਕੋਈ ਵੀ ਇਨਸਾਨ ਖੁਸ਼ ਵੀ ਹੋ ਜਾਂਦਾ ਹੈ ਅਤੇ ਆਪਾਂ ਸਮੇਂ ਰਹਿੰਦੇ ਉਹ ਆਪਾਂ ਕੁਛ ਕਿਸੇ ਦੇ ਖਾਣ ਵਾਸਤੇ ਬਣਾ ਸਕਦੇ ਹਾਂ ਅਤੇ ਖੁਸ਼ੀ ਦੇ ਮੌਕਿਆਂ ਵਿੱਚ ਵੀ ਆਪਾਂ ਖੀਰ ਸਭ ਤੋਂ ਅੱਗੇ ਰੱਖਦੇ ਹਾਂ ਕਿਉਂਕਿ ਉਹ ਇੱਕ ਮਿੱਠਾ ਹੁੰਦਾ ਹੈ ਅਤੇ ਮਿੱਠਾ ਹੀ ਖੁਸ਼ੀਆਂ ਮ ਖੁਸ਼ੀਆਂ ਦੇ ਵਿੱਚ ਮਿੱਠਾ ਹੀ ਜ਼ਿਆਦਾ ਪ੍ਰਸਿੱਧ ਹੁੰਦਾ ਹੈ ਮੈਨੂੰ ਸਭ ਤੋਂ ਔਖਾ ਜੋ ਬਣਾਉਣਾ ਲੱਗਦਾ ਹੈ ਉਹ ਸਾਗ ਹੈ ਕਿਉਂਕਿ ਉਸ ਦੀ ਬਹੁਤ ਹੀ ਲੰਬੀ ਪ੍ਰਕਿਰਿਆ ਹੁੰਦੀ ਹੈ ਅਤੇ ਜੇ ਕਿਸੇ ਜਦੋਂ ਵੀ ਸਾਗ ਬਣਾਉਣਾ ਹੁੰਦਾ ਤਾਂ ਬਹੁਤ ਸਮੇਂ ਪਹਿਲਾਂ ਹੀ ਉਸਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਬਣਾਉਣ ਦੇ ਲਈ ਚਾਰ ਪੰਜ ਘੰਟੇ ਤਾਂ ਲੱਗ ਹੀ ਜਾਂਦੇ ਹਨ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਸਾਗ ਨੂੰ ਚੁਗਣਾ ਪੈਂਦਾ ਹੈ ਉਸਦੇ ਚੰਗੇ ਅਤੇ ਜੋ ਖਰਾਬ ਪੱਤੇ ਹਨ ਉਹਨਾਂ ਨੂੰ ਅਲੱਗ ਅਲੱਗ ਕਰਨਾ ਪੈਂਦਾ ਹੈ ਫਿਰ ਉਸਨੂੰ ਕੱਟਣਾ ਪੈਂਦਾ ਹੈ ਫਿਰ ਉਸਨੂੰ ਅੱਗ 'ਤੇ ਰੱਖ ਕੇ ਉਦੋਂ ਤੱਕ ਉਸ ਨੂੰ ਘੋਲਣਾ ਪੈਂਦਾ ਹੈ ਜ ਜਿਨ੍ਹਾਂ ਤੱਕਰ ਉਹ ਇੱਕ ਪੇਸਟ ਦੇ ਰੂਪ ਵਿੱਚ ਨਹੀਂ ਆ ਜਾਂਦਾ ਫਿਰ ਉਸਨੂੰ ਘੋਟਣਾ ਪੈਂਦਾ ਹੈ ਕਿ ਉਹ ਮੁਲਾਇਮ ਹੋ ਜਾਵੇ ਅਤੇ ਅਤੇ ਫਿਰ ਉਸਨੂੰ ਤੜਕਾ ਲਾ ਕੇ ਪਿਆਜ਼ ਅਦਰਕ ਲਸਣ ਦਾ ਤੜਕਾ ਲਾ ਕੇ ਫਿਰ ਉਸਨੂੰ ਖਾਧਾ ਜਾਂਦਾ ਹੈ ਜਿਸ ਇਸਦੀ ਪ੍ਰਕਿਰਿਆ ਬਹੁਤ ਹੀ ਲੰਬੀ ਹੈ ਅਤੇ ਬਹੁਤ ਹੀ ਧਿਆਨ ਨਾਲ ਕਰਨਾ ਪੈਂਦਾ ਹੈ ਇਸ ਲਈ ਮੈਨੂੰ ਇਹ ਸਭ ਤੋਂ ਔਖਾ ਲੱਗਦਾ ਹੈ ਧੰਨਵਾਦ ਜੀ